ਸਮਾਰਟ ਫ਼ੋਨ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਬਿਹਤਰ ਬਣਾਇਆ ਹੈ ਸਮਾਰਟ ਫ਼ੋਨ ਦੇ ਆਉਣ ਨਾਲ ਬਹੁਤ ਸਾਰੀਆਂ ਚੀਜ਼ਾਂ ਦਾ ਬਹੁਤ ਸਾਰੀਆਂ ਚੀਜ਼ਾਂ ਦਾ ਮਸਲਾ ਹੱਲ ਹੋ ਗਿਆ ਸਾਡਾ ਟਾਈਮ ਵੇਸਟ ਹੋਣ ਵਾਲਾ ਜੋ ਕਿ ਬਹੁਤ ਸਮਾਰਟ ਫ਼ੋਨ ਨੇ ਬਹੁਤ ਵਧੀਆ ਬਣਾ ਦਿੱਤਾ ਜਿਵੇਂ ਕਿ ਨੈੱਟ ਬੈਂਕਿੰਗ ਨੂੰ ਸੌਖਾ ਕਰ ਦਿੱਤਾ ਅੱਜ ਕੱਲ੍ਹ ਫ਼ੋਨਾਂ ਰਾਹੀਂ ਸਮਾਰਟ ਫ਼ੋਨ ਦੀ ਜ਼ਿੰਦਗੀ ਨੂੰ ਇੰਨਾਂ ਸੁਖਾਲਾ ਕਰ ਦਿੱਤਾ ਜਿਵੇਂ ਹਰ ਇੱਕ ਮੁਸ਼ਕਿਲ ਦਾ ਹੱਲ ਘਰ ਬੈਠੇ ਹੀ ਹੋ ਜਾਂਦਾ ਹੈ ਆਸਾਨੀ ਨਾਲ ਸਾਰੇ ਹੱਲ ਕੀਤੇ ਜਾ ਸਕਦੇ ਨੇ ਅੱਜ ਕੱਲ੍ਹ ਸਾਰਾ ਕੁਝ ਫ਼ੋਨ 'ਤੇ ਹੀ ਉਪਲਬਧ ਹੈ ਔਨਲਾਈਨ ਸ਼ੋਪਿੰਗ ਔਨਲਾਈਨ ਕਲਾਸਾਂ ਔਨਲਾਈਨ ਬਿੱਲ ਭਰਨਾ ਹਾਲਾਂਕਿ ਪੜ੍ਹਾਈ ਵੀ ਔਨਲਾਈਨ ਸਮਾਰਟ ਫ਼ੋਨ 'ਤੇ ਹੀ ਹੁੰਦੀ ਹੈ